ਆਮ ਤੌਰ 'ਤੇ ਸਾਰੇ ਹੀ ਇਲਾਕਿਆਂ ਵਿੱਚ ਕ੍ਰਿਕਟ ਬੈਡਮਿੰਟਨ ਅਤੇ ਬਾਲੀਬੋਲ ਬੱਚੇ ਖੇਡਣਾ ਪਸੰਦ ਕਰਦੇ ਹਨ ਪਰ ਮੇਰੇ ਇਲਾਕੇ ਵਿੱਚ ਰਵਾਇਤੀ ਖੇਡਾਂ ਹਨ ਜਿਵੇਂ ਕਿ ਪਿੱਠੂ ਗਰਮ ਬਾਂਦਰ ਕਿੱਲਾ ਲੁਕਣ ਮਿਚੀ ਗੁੱਲੀ ਡੰਡਾ ਮੇਰੇ ਇਲਾਕੇ ਵਿੱਚ ਜ਼ਿਆਦਾਤਰ ਬੱਚੇ ਇਸ ਖੇਡਾਂ ਨੂੰ ਸ਼ਾਮ ਦੇ ਸਮੇਂ ਖੇਡਦੇ ਹਨ ਕਿਉਂਕਿ ਇਹ ਖੇਡਾਂ ਬਹੁਤ ਹੀ ਜ਼ਿਆਦਾ ਰੋਚਕ ਹਨ ਅਤੇ ਨਾਲ਼ ਹੀ ਨਾਲ਼ ਕੁਝ ਬੱਚੇ ਪਤੰਗਬਾਜ਼ੀ ਵੀ ਕਰਨਾ ਪਸੰਦ ਕਰਦੇ ਹਨ ਇਸ ਖੇਡਾਂ ਨਾਲ਼ ਬੱਚਿਆਂ ਦਾ ਇਕੱਠਿਆਂ ਸਮਾਂ ਬਤੀਤ ਹੁੰਦਾ ਹੈ